ਸਹਿਯੋਗੀ ਡਰਾਇੰਗ ਵਿੱਚ ਅਤੇ ਫੀਡਬੈਕ ਦੋ ਮੁੱਖ ਹੁੰਦੇ ਹਨ ਮੰਨ ਲਓ ਜੇ ਮੈਂ ਚੰਗਾ ਬਣਾਇਆ ਹੈ ਅਤੇ ਦੂਸਰੇ ਸਹਿਯੋਗੀ ਨੇ ਬਰਾਬਰ ਦਾ ਸਾਥ ਨਹੀਂ ਦਿੱਤਾ ਤਾਂ ਦੂਸਰੇ ਸਹਿਯੋਗੀ ਨਾਲ ਥੋੜ੍ਹਾ ਆਪਾਂ ਨਿਰਾਸ਼ ਹੋਵਾਂਗੇ ਮੇਰੀ ਮਿਹਨਤ ਬੇਕਾਰ ਗਈ ਅਜਿਹੇ ਵਿੱਚ ਦੋਵਾਂ ਦੀ ਹੀ ਆਲੋਚਨਾ ਹੋਵੇਗੀ ਜੇਕਰ ਅਸੀਂ ਦੋਵਾਂ ਦੀ ਡਰਾਇੰਗ ਚੰਗੀ ਹੋਵੇਗੀ ਤਾਂ ਸਾਨੂੰ ਦੋਹਾਂ ਨੂੰ ਹੀ ਫੀਡਬੈਕ ਮਿਲੇਗਾ ਇੱਕ ਵਾਰ ਅਸੀਂ ਕਿਸੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਾਡੇ ਕੋਲ ਕੁਝ ਕੁ ਗਲਤੀਆਂ ਹੋ ਗਈਆਂ ਪਰ ਸਾਡੀ ਟੀਮ ਨੇ ਇਹਨਾਂ ਗਲਤੀਆਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਗਲਤੀਆਂ ਵਿੱਚ ਸੁਧਾਰ ਕੀਤਾ ਅਤੇ ਉਹ ਸਾਡਾ ਕੰਮ ਬਹੁਤ ਹੀ ਸੋਹਣਾ ਬਣਿਆ ਇਸ ਲਈ ਟੀਮ ਵਰਕ ਵਿੱਚ ਇਹ ਕਿਸੇ ਦੂਸਰੇ ਦੇ ਕਾਰਨ ਆਲੋਚਨਾ ਅਤੇ ਪ ਪ੍ਰਸੰਸਾ ਦੋਨੇ ਹੀ ਮਿਲ ਸਕਦੇ ਹਨ ਆਪਣੇ ਆਪ ਤੋਂ ਵੀ ਕਈ ਵਾਰ ਗਲਤੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ ਇਸ ਲਈ ਟੀਮ ਵਿੱਚ ਕੰਮ ਕਰਨਾ ਫਾਇਦੇਮੰਦ ਵੀ ਹੈ ਅਤੇ ਨੁਕਸਾਨਦਾਇਕ ਵੀ